ਸਤਿ ਸ੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਨਿਵਾਸੀ ਪਠਾਨਕੋਟ ਦੀ ਰਹਿਣ ਵਾਲੀ ਹਾਂ ਵੈਸੇ ਤਾਂ ਮੈਂ ਤੁਹਾਡੀ ਸਾਈਟ ਸਵੀਗੀ ਤੋਂ ਕਾਫ਼ੀ ਕੁਛ ਖਾਣ ਨੂੰ ਮੰਗਵਾਉਂਦੀ ਰਹਿੰਦੀ ਹਾਂ ਅਤੇ ਹੁਣ ਅੱਜ ਮੈਂ ਆਪਣੀ ਸਹੇਲੀਆਂ ਨੂੰ ਇੱਕ ਛੋਟੀ ਜਿਹੀ ਪਾਰਟੀ ਦੇਣ ਲਈ ਤੁਹਾਡੀ ਸਾਈਟ ਤੋਂ ਦੋ ਪਲੇਟ ਮੱਖਣੀ ਅਤੇ ਸ਼ਾਹੀ ਪਨੀਰ ਪਲੇਨ ਰਾਈਸ ਤੰਦੂਰੀ ਰੋਟੀ ਆਦਿ ਮੰਗਵਾਉਣਾ ਸੀ ਪਰ ਫਿਰ ਮੈਨੂੰ ਯਾਦ ਆਇਆ ਕਿ ਮੈਂ ਤਾਂ ਆਪਣੇ ਪੁਰਾਣੇ ਐਡਰੈੱਸ ਹੀ ਦਿੱਤਾ ਹੋਇਆ ਸੀ ਉਸ ਔਡਰ 'ਚੋਂ ਜਿਸ ਦੀ ਔਡਰ ਆਈ ਡੀ ਦੋ ਛੇ ਸੱਤ ਨੌਂ ਪੰਜ ਹੈ ਪਰ ਹੁਣ ਜੋ ਕਿ ਅਸੀਂ ਘਰ ਸ਼ਿਫਟ ਕਰ ਲਿਆ ਹੈ ਕਿਉਂਕਿ ਪਹਿਲਾਂ ਅਸੀਂ ਰੈਂਟ 'ਤੇ ਰਹਿੰਦੇ ਸੀ ਅਤੇ ਹੁਣ ਆਪਣਾ ਨਵਾਂ ਘਰ ਲੈ ਲਿਆ ਹੈ ਅਤੇ ਹੁਣ ਮੈਂ ਤੁਹਾਡੇ ਤੋਂ ਇਹੀ ਸਹਾਇਤਾ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਨਵਾਂ ਐਡਰੈੱਸ ਅਪਡੇਟ ਕਰ ਦਿਉ ਜੋ ਕਿ ਹੈ ਸੈਕਟਰ ਬਾਰਾਂ ਸੀ ਰੇਲਵੇ ਰੋਡ ਖਰੜ ਤੁਸੀਂ ਜਲਦੀ ਤੋਂ ਜਲਦੀ ਇਹ ਕੰਮ ਕਰ ਦਿਉ ਤਾਂ ਕਿ ਮੇਰਾ ਔਡਰ ਪੁਰਾਣੇ ਘਰ ਨਾ ਚਲਾ ਜਾਏ ਧੰਨਵਾਦ ਜੀ